ਮੈਨੂੰ ਬਚਪਨ ਤੋਂ ਹੀ ਉਚਾਈ ਤੋਂ ਬਹੁਤ ਡਰ ਲੱਗਦਾ ਹੁੰਦਾ ਸੀ ਮੈਨੂੰ ਉੱਚੇ ਪਹਾੜਾਂ ਜਾਂ ਕਿਸੇ ਉੱਚੀ ਮੰਜ਼ਿਲ 'ਤੇ ਖੜ੍ਹੇ ਹੋ ਕੇ ਨੀਚੇ ਵੱਲ ਨਿਗ੍ਹਾ ਮਾਰਨ ਵਿੱਚ ਕਾਫੀ ਡਰ ਲੱਗਦਾ ਹੁੰਦਾ ਸੀ ਇਹ ਫੋਬੀਆ ਮੇਰਾ ਇੱਕ ਵਾਰ ਖਤਮ ਕਰ ਦਿੱਤਾ ਗਿਆ ਇੱਕ ਵਾਰ ਮੈਂ ਆਪਣੇ ਕੋਲਜ ਦੇ ਨਾਲ ਟ੍ਰੈਕ ਉੱਤੇ ਗਈ ਜੇ ਜਿੱਥੇ ਸਾਨੂੰ ਗਰੁੱਪਾਂ ਵਿੱਚ ਵੰਡਿਆ ਗਿਆ ਅਤੇ ਵੱਖਰੀਆਂ ਵੱਖਰੀਆਂ ਟੀਮਾਂ ਬਣਾਈਆਂ ਗਈਆਂ ਅਤੇ ਟਰੈਕਿੰਗ ਦੀ ਸ਼ੁਰੂਆਤ ਕੀਤੀ ਗਈ ਟਰੈਕਿੰਗ ਵਿੱਚ ਸਾਨੂੰ ਕਾਫੀ ਪਹਾੜਾਂ 'ਤੇ ਚੜ੍ਹਨਾ ਪਿਆ ਅਤੇ ਉੱਚਾਈਆਂ ਨੂੰ ਛੂਹਣਾ ਪਿਆ ਉੱਥੇ ਜਾ ਕੇ ਬਾਕੀਆ ਨਾਲ ਰਲ ਕੇ ਮੈਂ ਪਹਾੜਾਂ 'ਤੇ ਟਰੈਕਿੰਗ ਕੀਤੀ ਅਤੇ ਆਪਣਾ ਫੋਬੀਆ ਥੋੜ੍ਹਾ ਦੂਰ ਕੀਤਾ ਉੱਥੇ ਜਾ ਕੇ ਮੇਰਾ ਫੋਬੀਆ ਘੱਟ ਹੋਇਆ ਅਤੇ ਮੈਂ ਕਾਫੀ ਮ ਮਨੋਰੰਜਨ ਕੀਤਾ ਮੇਰੇ ਅੰਦਰ ਜੋ ਪਹਾੜਾਂ ਨੂੰ ਲੈ ਕੇ ਅਤੇ ਉੱਚਾਈ ਦਾ ਡਰ ਸੀ ਉਹ ਹੌਲੀ ਹੌਲੀ ਖਤਮ ਹੋਣ ਲੱਗ ਗਿਆ ਅਤੇ ਮੈਂ ਟਰੈਕਿੰਗ ਨੂੰ ਪੂਰੀ ਤਰ੍ਹਾਂ ਮ ਇੰਨਜੋਏ ਕਰਨ ਲੱਗ ਗਈ ਅਤੇ ਮੈਂ ਕਾਫੀ ਪਹਾੜਾਂ ਤੋਂ ਚੜ੍ਹਿਆ ਅਤੇ ਪਹਾੜਾਂ ਦਾ ਉੱਚਾਈ ਦਾ ਨਜ਼ਾਰਾ ਲਿਆ ਉੱਚਾਈ ਦਾ ਨਜ਼ਾਰਾ ਲਿਆ ਇੱਦਾਂ ਹੀ ਮੈਂ ਕਾਫੀ ਹੋਰ ਵੀ ਟਰੈਕ ਕੀਤੇ ਹਨ ਮੈਂ ਧੰਨਵਾਦ ਕਰਦੀ ਹਾਂ ਆਪਣੇ ਕੋਲਜ ਵਾਲਿਆਂ ਦਾ ਜਿਸ ਕਰਕੇ ਸਾਨੂੰ ਇਹ ਟਰੈਕਿੰਗ ਕਰਨ ਦਾ ਮੌਕਾ ਮਿਲਿਆ ਸੀ ਅਤੇ ਮੇਰਾ ਇਹ ਫੋਬੀਆ ਦੂਰ ਹੋਇਆ